ਹੈਲੋ ਹਾਂਜੀ ਅਮਨ ਕਿਵੇਂ ਹੋ ਵਧੀਆ ਵਧੀਆ ਲੋਟ ਹੋਰ ਬਸ ਕੁਛ ਨਹੀਂ ਬਸ ਆਹੀ ਖੇਤੀ ਚੀਵ ਲੱਗੇ ਹੋਏ ਹਾਂ ਪਾਣੀ ਪੂਣੀ ਲਾ ਕੇ ਹੱਟਿਆ ਕਣਕ ਨੂੰ ਹਾਂ ਰਾਤ ਹੀ ਲਾ ਕੇ ਹਟਿਆ ਠੀਕ ਆ ਠੀਕ ਆ ਪਿੰਡ 'ਚ ਕੁਛ ਨੀ ਬਸ ਆਹ ਖੇਤੀ ਅਫਸਰ ਆਏ ਸੀਗੇ ਉਹ ਦਾ ਰੌਲਾ ਜਿਹਾ ਸੀ ਕੱਲ੍ਹ ਇਕੱਠ ਜਿਹਾ ਜਾ ਸੀਗਾ ਖੇਤੀ ਅਫਸਰ ਤਾਂ ਆਹੀ ਗੱਲ ਕਰਦੇ ਸੀ ਕਿ ਨਾ ਨਾ ਕਹਿੰਦੇ ਵੀ ਗਰਮੀ ਵੱਧ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਉਹਦੇ ਨਾਲ ਫ਼ਸਲਾਂ ਖ਼ਰਾਬ ਹੁੰਦੀਆਂ ਨੇ ਉਹਦੇ ਬਾਰੇ ਗੱਲ ਕਰਦੇ ਸੀ ਕਹਿੰਦੇ ਹਾਂ ਹਾਂ ਪਤਾ ਹੀ ਤੁਹਾਨੂੰ ਸੈਕਟਰਾ 'ਤੇ ਕੀ ਪ੍ਰਭਾਵ ਪੈਂਦੇ ਆ ਫ਼ਸਲਾਂ 'ਤੇ ਗਲੋਬਲ ਵਾਰਮਿੰਗ ਦੇ ਹਾਂ ਹਾਂ ਉਹ ਝਾੜ ਘਟੀ ਜਾਂਦੇ ਆ ਹੈ ਨਾ ਹੜ੍ਹ ਆ ਜਾਂਦੇ ਆ ਸੋਕੇ ਪੈ ਜਾਂਦੇ ਆ ਬੁਰਾ ਹਾਲ ਹੋਇਆ ਪਿਆ ਗਰਮੀ ਇੰਨੀ ਹੋ ਜਾਂਦੀ ਹੈ ਠੰਡ 'ਚ ਠੰਡ ਹੋ ਜਾਂਦੀ ਹੈ ਵਾ ਪ੍ਰਭਾਵਾਂ ਬਾਰੇ ਹੀ ਗੱਲ ਕੀਤੀ ਆ ਮੇਨ ਤਾਂ ਉਹਨਾਂ ਨੇ ਵੀ ਪ੍ਰਭਾਵ ਬਹੁਤ ਪੈ ਰਹੇ ਨੇ ਗਲੋਬਵ ਵਾਰਮਿੰਗ ਦੇ ਜਿਹੜੀ ਇੰਨੀ ਤਪਸ਼ ਹੋ ਰਹੀ ਆ ਹਮ ਹਮ ਹਾਂ ਬਾਕੀ ਬਸ ਬਹੀ ਗੱਲ ਕਰਦੇ ਸੀ ਕਹਿੰਦੇ ਵੀ ਹੁਣ ਜਿਹੜੀ ਇੱਕ ਰਸਾਇਣਕ ਖਾਦਾਂ ਬਹੁਤ ਵਰਤਣ ਲੱਗ ਗਏ ਕਹਿੰਦੇ ਔਰਗੈਨਿਕ ਖੇਤੀ ਕਰੋ ਵਿੱਚ ਇਹ ਗੱਲ ਕਰ ਰਹੇ ਸੀਗੇ ਹਮ ਹਾਂ ਚੱਲ ਠੀਕ ਹਮ ਚੱਲ ਮੈਂ ਵੀ ਮਾੜਾ ਕਰਲਾ ਵੱਡ ਟੁਕ ਜਾ ਕਰਨਾਗਾ ਪਸ਼ੂਆਂ ਦਾ ਕਰਨਾ ਸ਼ਾਮ ਨੂੰ ਘਰ ਨੂੰ ਫਿਰ ਹਾਂ ਮਿਲਦੇ ਹਾਂ ਫਿਰ ਆਪਾਂ ਓਕੇ ਓਕੇ